ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਕਿਸੇ ਵਿਅਕਤੀ ਲਈ ਸਾਡੇ ਪਿੰਡ ਵਿੱਚ ਬਹੁਤ ਸਾਰੇ ਘਰੇਲੂ ਉਪਚਾਰ ਹਨ ਮੇਰੇ ਪਿੰਡ ਵਿੱਚ ਭਾਰ ਘਟਾਉਣ ਲਈ ਘਰੇਲੂ ਉਪਚਾਰ ਬਹੁਤ ਮਸ਼ਹੂਰ ਹਨ ਜੋ ਕਿ ਸੌਖੇ ਅਤੇ ਪ੍ਰਭਾਵਸ਼ਾਲੀ ਹਨ ਸਵੇਰੇ ਜਿਵੇਂ ਕਿ ਨਿੰਬੂ ਪਾਣੀ ਪੀਣਾ ਬਹੁਤ ਆਮ ਹੈ ਜਿਸ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅੰਜੀਰੀ ਜਾ ਸੋਂਫ ਦਾ ਪਾਣੀ ਰਾਤ ਨੂੰ ਭਿਗੋ ਕੇ ਸਵੇਰੇ ਪੀਣ ਨਾਲ ਵੀ ਭਾਰ ਘਟਾਉਣ ਵਿੱਚ ਬਹੁਤ ਮਦਦ ਮਿਲਦੀ ਹੈ ਤੁਲਸੀ ਅਤੇ ਅਦਰਕ ਦੀ ਚਾਹ ਡਜੀਸ਼ਨ ਨੂੰ ਵਧੀਆ ਬਣਾਉਂਦੀ ਹੈ ਅਤੇ ਚਰਬੀ ਘਟਾਉਣ ਵਿੱਚ ਵੀ ਬਹੁਤ ਮਦਦ ਕਰਦੀ ਹੈ ਗੂਗਲ ਅਤੇ ਜਾਮੁਨ ਦਾ ਰਸ ਵੀ ਭਾਰ ਘਟਾਉਣ ਲਈ ਬਹੁਤ ਹੀ ਫਾਇਦੇਮੰਦ ਹੈ ਜਿਹੜੇ ਵਿਅਕਤੀ ਜਿੰਮ ਨਹੀਂ ਜਾ ਸਕਦੇ ਉਹ ਘਰ ਵਿੱਚ ਹੀ ਕਸਰਤ ਕਰਦੇ ਹਨ ਜਿਵੇਂ ਕਿ ਘਰ ਵਿੱਚ ਪੌੜੀਆਂ ਉਤਰਨਾ ਚੜ੍ਹਨਾ ਯੋਗਾ ਕਰਨੀ ਆਦਿ ਇਹਨਾਂ ਨਾਲ ਹੀ ਬਹੁਤ ਕਸਰਤ ਹੋ ਜਾਂਦੀ ਹੈ ਨਾਲ ਹੀ ਰੋਜ਼ ਤੀਹ ਚਾਲ੍ਹੀ ਮਿੰਟ ਤੱਕ ਤੁਰਨਾ ਜਾਂ ਕਿਸੇ ਵੀ ਲਾਭਦਾਇਕ ਸਰੀਰਕ ਕਿਰਿਆ ਵਿੱਚ ਸ਼ਾਮਿਲ ਹੋਣਾ ਬਹੁਤ ਹੀ ਮਹੱਤਵਪੂਰਨ ਹੈ ਧੰਨਵਾਦ